ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰੀਤ ਹੋਟਲ ਤੋਂ ਬੋਲਦੇ ਜੀ ਹਾਂਜੀ ਭਾਅ ਜੀ ਜਿੱਦਾਂ ਕਿ ਮੇਰੇ ਯਾਰ ਦੋਸਤ ਨੇ ਦੱਸਿਆ ਸੀਗਾ ਵੀ ਤੁਹਾਡਾ ਰੈਸਟੋਰੈਂਟ ਬਹੁਤ ਸੋਹਣਾ ਹੈ ਜੀ ਅਤੇ ਅਸੀਂ ਟਰੇਨ ਦੇ ਵਿੱਚ ਆਉਣਾ ਸੀਗਾ ਜੀ ਇੱਧਰ ਘੁੰਮਣ ਜਿੱਦਾਂ ਕਿ ਮੌਸਮ ਖਰਾਬ ਹੋਵੇ ਅਤੇ ਸਾਨੂੰ ਤੁਸੀਂ ਉੱਥੇ ਖਾਣਾ ਪਹੁੰਚਾ ਦੂਗੇ ਜੀ ਅਤੇ ਕੋਈ ਨਹੀਂ ਅਸ ਅਸੀਂ ਐਕਸਟਰਾ ਚਾਰਜ ਵੀ ਤੁਹਾਨੂੰ ਦੇ ਦੇਵਾਂਗੇ ਚਲੋ ਠੀਕ ਹੈ ਧੰਨਵਾਦ ਜੀ